ਇਸ ਖੇਤਰ ਦੇ ਲੋਕ ਗੀਤ ਹਨ ਟੱਪੇ ਬੋਲੀਆਂ ਅਤੇ ਰੱਤੀ ਅਤੇ ਜ਼ਿਆਦਾਤਰ ਇਹ ਜਿਹੜੇ ਵਿਆਹ ਸ਼ਾਦੀਆਂ ਵਿੱਚ ਗਾਏ ਜਾਂਦੇ ਹੈ